ਖੇਤੀਬਾੜੀ ਵਿੱਚ ਟੈਕਨੋਲੋਜੀ ਨੇ ਸਾਡੀ ਬਹੁਤ ਮਦਦ ਕੀਤੀ ਹੈ ਕਿਉਂਕਿ ਇੱਕ ਇਨਸਾਨ ਦਾ ਦਾਇਰਾ ਬਹੁਤ ਹੀ ਸੀਮਿਤ ਹੁੰਦਾ ਹੈ ਟੈਕਨੋਲੋਜੀ ਨਾਲ ਅਸੀਂ ਜ਼ਿਆਦਾ ਭਾਰ ਚੁੱਕ ਸਕਦੇ ਹਾਂ ਅਤੇ ਇਹਨਾਂ ਨਾਲ ਅਸੀਂ ਖੇਤਾਂ ਨੂੰ ਜੋਦਨਾ ਪਾਣੀ ਨਿਕਾਲਣਾ ਅਤੇ ਜਿਣਸ ਨੂੰ ਮੰਡੀਆਂ ਵਿੱਚ ਬੜੀ ਆਸਾਨੀ ਨਾਲ ਪਹੁੰਚਾ ਸਕਦੇ ਹਾਂ